ਨਮਸਕਾਰ ਮੈਂ ਰਾਜਕੁਮਾਰ ਡਿਸਟ੍ਰਿਕਟ ਗੁਰਦਾਸਪੁਰ ਦਾ ਰਹਿਣ ਵਾਲਾ ਹਾਂ ਮੇਰੇ ਬੱਚੇ ਦਾ ਜਨਮ ਉੱਨੀ ਅਪ੍ਰੈਲ ਵੀਹ ਸੌ ਚੌਵੀ ਨੂੰ ਹੋਇਆ ਸੀ ਉਸ ਦੀ ਰਜਿਸਟਰੇਸ਼ਨ ਵਾਸਤੇ ਮੈਂ ਰਜਿਸਟਨ ਦਫਤਰ ਵਿੱਚ ਐਪਲੀਕੇਸ਼ਨ ਦਿੱਤੀ ਤਾਂ ਉਸ ਤੋਂ ਪੰਦਰ੍ਹਾਂ ਵੀਹ ਦਿਨ ਬਾਅਦ ਮੇਰੇ ਬੱਚੇ ਦਾ ਸਰਟੀਫਿਕੇਟ ਬਣ ਕੇ ਆ ਗਿਆ ਉਸ ਵਿੱਚ ਜਦੋਂ ਮੈਂ ਵੇਖਿਆ ਤਾਂ ਉਸ ਵਿੱਚ ਨਾਂ ਦੀ ਮਿਸਟੇਕ ਸੀ ਮੈਂ ਦੁਬਾਰਾ ਰਜਿਸਟਰੇਸ਼ਨ ਔਫਿਸ ਵਿੱਚ ਅਪਲਾਈ ਕਰਕੇ ਉਹਨਾਂ ਨੂੰ ਗਲਤੀ ਸੁਧਾਰਨ ਬਾਰੇ ਦੱਸਿਆ ਤਾਂ ਉਹਨਾਂ ਨੇ ਕਿਹਾ ਕਿ ਪੰਜ ਚਾਰ ਦਿਨ ਤੱਕ ਹੋ ਜਾਵੇਗਾ ਠੀਕ ਹੈ ਫੇਰ ਉਹਨਾਂ ਨੂੰ ਮੈਂ ਦੁਬਾਰਾ ਇੱਕ ਗੱਲ ਹੋਰ ਬੋਲੀ ਕਿ ਬਈ ਇਹ ਗਲਤੀ ਚਲੋ ਮੇਰੇ ਨਾਲ ਹੋਈ ਹੈ ਅੱਗੇ ਹੋਰ ਕਿਸੇ ਨਾਲ ਨਾ ਹੋਵੇ ਜਦੋਂ ਵੀ ਕੋਈ ਸਰਟੀਫਿਕੇਟ ਜਾਂ ਕੋਈ ਚੀਜ਼ ਤਿਆਰ ਕਰਦੇ ਆ ਦੇਖਦੇ ਹੋ ਉਹਦੇ ਵਿੱਚ ਨਾਂ ਦੀ ਜ਼ਰੂਰ ਸਿਹਾਰੀ ਬਿਹਾਰੀ ਦਾ ਧਿਆਨ ਨਾਲ ਕੀਤਾ ਜਾਵੇ ਤਾਂ ਕਿ ਆਉਣ ਵਾਲੇ ਟਾਈਮ 'ਚ ਹੋਰ ਲੋਕਾਂ ਨੂੰ ਵੀ ਇਸ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪਵੇ ਤਾਂ ਕਿ ਸਾਰੇ ਕੋਈ ਵੀ ਆਪਣਾ ਸਰਟੀਫਿਕੇਟ ਬਣਾਉਂਦਾ ਉਹਨੂੰ ਕੋਈ ਮੁਸ਼ਕਲ ਨਾ ਆਵੇ ਕੋਈ ਨੌਕਰੀ ਵੇਲੇ ਜਾਂ ਬੱਚੇ ਨੂੰ ਕੋਈ ਦਿੱਕਤ ਪਰੇਸ਼ਾਨੀ ਨਾ ਆਵੇ ਇਹੋ ਹੀ ਅਪੀਲ ਕਰਦਾ ਉਹਦੇ ਬਾਅਦ ਮੇਰਾ ਸਰਟੀਫਿਟੇਕ ਪੰਦਰ੍ਹਾਂ ਦਿਨਾਂ ਬਾਅਦ ਠੀਕ ਹੋ ਕੇ ਰਜਿਸਟਰੇਸ਼ਨ ਔਫਿਸਰ ਰਾਹੀਂ ਮੇਰੇ ਘਰ ਪੰਦਰ੍ਹਾਂ ਦਿਨਾਂ ਬਾਅਦ ਪਹੁੰਚ ਗਿਆ ਮੈਂ ਧੰਨਵਾਦ ਕਰਦਾ ਹਾਂ ਇਹਨਾਂ ਦਾ